ਭਾਰਤ ਵਿੱਚ ਮੌਸਮ ਇਕਸਾਰ ਨਹੀਂ ਰਹਿੰਦਾ ਜੰਮੂ ਕਸ਼ਮੀਰ ਵਰਗੇ ਇਲਾਕੇ ਦੇ ਵਿੱਚ ਬ ਬਹੁਤ ਜ਼ਿਆਦਾ ਬਰਫ਼ ਪੈਂਦੀ ਹੈ ਬੰਬਈ ਵਰਗੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ ਅਤੇ ਇੱਥੇ ਕਦੇ ਵੀ ਬਹੁਤ ਜ਼ਿਆਦਾ ਠੰਡ ਨਹੀਂ ਹੁੰਦੀ ਪੰਜਾਬ ਦੇ ਵਿੱਚ ਚਾਰੋਂ ਤਰ੍ਹਾਂ ਦੀਆਂ ਰੁੱਤਾਂ ਆਉਂਦੀਆਂ ਹਨ ਗਰਮੀ ਗਰਮੀਆਂ ਅਪ੍ਰੈਲ ਤੋਂ ਸ਼ੁਰੂ ਹੋ ਕੇ ਜੁਲਾਈ ਤੱਕ ਹੁੰਦੀਆਂ ਹਨ ਸਰਦੀਆਂ ਦੀ ਰੁੱਤ ਸ਼ ਅਕਤੂਬਰ ਤੋਂ ਸ਼ੁਰੂ ਹੋ ਕੇ ਫ਼ਰਵਰੀ ਤੱਕ ਹੁੰ ਫ਼ਰਵਰੀ ਤੱਕ ਹੁੰਦੀ ਹੈ ਮਾਰਚ ਦੇ ਵਿੱਚ ਬਸੰਤ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ